ਹਾਂ ਮੈਨੂੰ ਕਿਸੇ ਚੀਜ਼ ਦਾ ਪੰਜਾਬੀ ਤੋਂ ਜਾਂ ਵਿੱਚ ਅਨੁਵਾਦ ਕਰਨਾ ਪਿਆ ਤਾਂ ਮੇਰਾ ਅਨੁਭਵ ਬਹੁਤ ਵਧੀਆ ਸੀ ਪੰਜਾਬੀ ਬਹੁਤ ਵਧੀਆ ਭਾਸ਼ਾ ਹੈ ਪਹਿਲੀ ਵਾਰ ਮੈਂ ਹਿੰਦੀ ਤੋਂ ਪੰਜਾਬੀ 'ਚ ਅਨੁਭਵ ਕਰਨ ਦੀ ਕੋਸ਼ਿਸ਼ ਕੀਤੀ ਉਹ ਅਨੁਭਵ ਮੇਰੇ ਲਈ ਬਹੁਤ ਹੀ ਵਧੀਆ ਸੀ ਮੈਂ ਹਿੰਦੀ ਨੂੰ ਪੰਜਾਬੀ ਵਿੱਚ ਬੋਲਣ ਦਾ ਅਨੁਭਵ ਬਹੁਤ ਵੱਖਰਾ ਸੀ ਮੈਂ ਪੰਜਾਬੀ ਨੂੰ ਵੱਖੋ ਵੱਖਰੇ ਤਰੀਕੇ ਨਾਲ ਬੋਲਣ ਦੀ ਕੋਸ਼ਿਸ਼ ਕੀਤੀ ਮੈਂ ਬਹੁਤ ਉਤਸ਼ਾਹਿਤ ਵੀ ਸੀ ਕਿ ਮੈਂ ਹਿੰਦੀ ਭਾਸ਼ਾ ਨੂੰ ਪੰਜਾਬੀ ਭਾਸ਼ਾ ਵਿੱਚ ਬੋਲ ਰਿਹਾ ਹਾਂ ਲਿਖ ਰਿਹਾ ਹਾਂ ਇਹ ਅਨੁਭਵ ਮੇਰੇ ਲਈ ਸਭ ਤੋਂ ਪਹਿਲਾ ਅਨੁਭਵ ਰਿਹਾ ਹੈ ਮੈਨੂੰ ਬਹੁਤ ਐਕਸਾਈਟਮੈਂਟ ਵੀ ਸੀ ਕਿ ਮੈਂ ਹਿੰਦੀ ਨੂੰ ਪੰਜਾਬੀ ਦਾ ਵਿੱਚ ਬੋਲਣ ਦਾ ਅਨੁਭਵ ਲੈ ਰਿਹਾ ਹਾਂ ਮੈਂ ਬੋਲਣ ਸਮੇਂ ਬਹੁਤ ਡਿਫੀਕਲਟੀ ਵੀ ਲੱਗੀ ਪਰ ਉਹ ਵੀ ਅਨੁਭਵ ਮੇਰੇ ਲਈ ਬਹੁਤ ਵਧੀਆ ਸੀ ਪੜ੍ਹਨ ਸਮੇਂ ਹਿੰਦੀ ਨੂੰ ਪੰਜਾਬੀ ਵਿੱਚ ਪੜ੍ਹਨਾ ਮੈਨੂੰ ਪਹਿਲਾਂ ਤਾਂ ਬਹੁਤ ਔਖਾ ਲੱਗਿਆ ਕੁਝ ਡਿਫੀਕਲਟੀਆਂ ਵੀ ਆਈਆਂ ਪਰ ਹੌਲੀ ਹੌਲੀ ਕਰਕੇ ਮੈਂ ਕੁਝ ਸ਼ਬਦਾਂ ਦਾ ਅਨੁਵਾਦ ਪੰਜਾਬੀ ਵਿੱਚ ਵੀ ਕਰਦਾ ਰਿਹਾ ਕਰਦੇ ਕਰਦੇ ਮੇਰੀ ਬੋਲਣ ਦੀ ਲਿਖਣ ਦੀ ਅਤੇ ਕੰਮ ਕਰਨ ਦੀ ਅਨੁਭਵ ਬਿਲਕੁਲ ਸਹੀ ਹੁੰਦੀ ਰਹੀ ਇਹ ਅਨੁਭਵ ਮੇਰੇ ਲਈ ਸਭ ਤੋਂ ਵਧੀਆ ਚੰਗਾ ਸੀ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਹਿੰਦੀ ਭਾਸ਼ਾ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਅਤੇ ਇੱਕ ਨਵਾਂ ਅਨੁਭਵ ਲਿਆ ਇਸ ਕਰਕੇ ਮੈਨੂੰ ਪੰਜਾਬੀ ਭਾਸ਼ਾ ਬੋਲਣੀ ਬਹੁਤ ਹੀ ਵਧੀਆ ਲੱਗੀ